ਮੈਂ ਇਹ ਚੀਜ਼ ਤਕਰੀਬਨ ਕਰਦਾ ਰਹਿੰਦਾ ਹਾਂ ਕਿਉਂਕਿ ਮੈਨੂੰ ਇਹ ਚੀਜ਼ ਕਰਨੀ ਬਹੁਤ ਪਸੰਦ ਲੱਗਦੀ ਹੈ ਕਿਸੇ ਲਈ ਲਿਖਣਾ ਕਿਸੇ ਨੂੰ ਅਸੀਂ ਜੋ ਲਿਖ ਕੇ ਦੇ ਦਿੰਦੇ ਹਾਂ ਉਹ ਉਹਨੂੰ ਯਾਦ ਰਹਿੰਦੀ ਹੈ ਕਿ ਇਸ ਨੇ ਮੇਰੇ ਲਈ ਕੁਛ ਆਪ ਲਿਖਿਆ ਹੈ ਮੇਰੀ ਇੱਕ ਸਕੂਲ ਦੀ ਫਰੈਂਡ ਸੀ ਉਹਦੀ ਬਹੁਤ ਸੋਹਣੀ ਇੱਕ ਫੋਟੋ ਇੱਕ ਦਿਨ ਮੈਂ ਫੇਸਬੁੱਕ 'ਤੇ ਦੇਖੀ ਉਹਨੂੰ ਮੈਂ ਸਕਰੀਨਸ਼ੌਟ ਮਾਰਿਆ ਉਹਦਾ ਉਹਨੂੰ ਮੈਂ ਭੇਜਿਆ ਅਤੇ ਉਹਦੇ ਉੱਪਰ ਕੁਛ ਲਾਈਨਾਂ ਲਿਖੀਆਂ ਸੀ ਜੋ ਕਿ ਉਸਨੂੰ ਬਹੁਤ ਪਸੰਦ ਆਈਆਂ ਉਹ ਮੈਨੂੰ ਕਹਿੰਦੀ ਕਿ ਤੂੰ ਇੱਦਾਂ ਕਰ ਵੀ ਲੈਂਦਾ ਤੈਨੂੰ ਲਿਖਣਾ ਵੀ ਆਉਂਦਾ ਮੈਂ ਕਿਹਾ ਜਿਹੜੀ ਚੀਜ਼ਾਂ ਸੋਹਣੀਆਂ ਹੋਣ ਉਹਦੇ ਉੱਤੇ ਕੁਛ ਨਾ ਕੁਛ ਲਿਖ ਲਈਦਾ ਅਤੇ ਉਹ ਇੰਨਾ ਜ਼ਿਆਦਾ ਖੁਸ਼ ਹੋਈ ਸੀ ਅਤੇ ਮੈਨੂੰ ਕਹਿੰਦੀ ਸੀ ਕਿ ਮੈਂ ਤੇਰੇ ਵਾਸਤੇ ਵੀ ਜ਼ਰੂਰ ਕੁਛ ਲਿਖਾਂਗੀ ਪਰ ਉਹਨੇ ਅੱਜ ਤੱਕ ਮੈਨੂੰ ਕੁਛ ਲਿਖ ਕੇ ਨਹੀਂ ਭੇਜਿਆ ਹੁਣ ਇਸ ਮੁਕਾਮ ਦੇ ਉੱਪਰ ਵੀ ਮੈਂ ਕੁਛ ਨਾ ਕੁਛ ਉਹਨੂੰ ਲਿਖ ਕਿ ਭੇਜਾਂਗਾ ਕਿ ਮੈਂ ਇੰਤਜ਼ਾਰ ਕਰ ਰਿਹਾ ਪਰ ਤੂੰ ਮੇਰੇ ਵਾਸਤੇ ਕੁਛ ਨਹੀਂ ਲਿਖ ਕੇ ਭੇਜਿਆ ਬਾਕੀ ਪੰਜਾਬ ਜੋ ਹੈ ਅੰਮ੍ਰਿਤਸਰ ਜੋ ਹੈ ਜਾਂ ਪੰਜਾਬੀ ਜੋ ਹੈ ਇਹ ਇੰਨੀ ਕੁ ਜ਼ਿਆਦਾ ਤਕੜੀ ਹੈ ਜਾਂ ਇਸ ਵਿੱਚ ਇੰਨੇ ਜ਼ਿਆਦੀਆਂ ਚੀਜ਼ਾਂ ਹਨ ਕਿ ਤੁਸੀਂ ਕਿਸੇ ਲਈ ਕੁਛ ਵੀ ਤੁਸੀਂ ਤਿਆਰ ਕਰ ਸਕਦੇ ਹੋ ਲਿਖ ਸਕਦੇ ਹੋ ਜੋ ਕਿ ਉਸਨੂੰ ਪਸੰਦ ਵੀ ਆਊਗਾ ਅਤੇ ਉਹ ਚੰਗਾ ਵੀ ਮਹਿਸੂਸ ਕਰੇਗਾ